ਮੈਨੂੰ ਸਮਾਜ ਦੀ ਰਿਐਲਟੀ ਦੇ ਨਾਲ ਜੁੜੀਆਂ ਫਿਲਮਾਂ ਪਸੰਦ ਹਨ ਜਿਵੇਂ ਕਿ ਹੁਣੇ ਇੱਕ ਫਿਲਮ ਆਈ ਸੀ ਬੈਚ ਦੋ ਹਜ਼ਾਰ ਤੇਰਾਂ ਉਸ ਵਿੱਚ ਮਨੁੱਖ ਦੀ ਉਸ ਮਨੁੱਖ ਦੀ ਕਹਾਣੀ ਹੈ ਜਿਹੜਾ ਜ਼ਿੰਦਗੀ ਨੂੰ ਕੁੱਝ ਹੋਰ ਫਲਸਫੇ ਨਾਲ ਵੇਖਦਾ ਸੀ ਪਰ ਜਦੋਂ ਰਿਐਲਿਟੀ 'ਤੇ ਆਉਂਦਾ ਹੈ ਤਾਂ ਉਹ ਹੋਰ ਜ਼ਿੰਦਗੀ ਨਿਕਲਦੀ ਹੈ ਉਹ ਪਹਿਲਾਂ ਇੱਕ ਹਲਵਾਈ ਬਣਨਾ ਚਾਹੁੰਦਾ ਸੀ ਪਰ ਪਿਤਾ ਦੀਆਂ ਭਾਵ ਭਾਵਨਾਵਾਂ ਨੂੰ ਦੂਜਿਆਂ ਸਾਹਮਣੇ ਲਿਆਉਣ ਲਈ ਪਿਤਾ ਦੀ ਗੱਲ ਨੂੰ ਦਿਖਾਉਣ ਲਈ ਉਹਨੂੰ ਪੁਲਿਸ ਵਿੱਚ ਜਾਣਾ ਚਾਹੁੰਦਾ ਹੈ ਪਹਿਲਾਂ ਉਹ ਸਿਰਫ਼ ਹੋਲਦਾਰ ਬਣਨਾ ਚਾਹੁੰਦਾ ਹੈ ਉਸ ਵਿਚ ਜਾਣ 'ਤੇ ਉਸ ਨੂੰ ਜ਼ਿੰਦਗੀ ਦੀ ਅਸਲੀਅਤ ਪਤਾ ਲੱਗਦੀ ਹੈ ਫਿਰ ਉੱਥੋਂ ਬਾਹਰ ਆਉਂਦਾ ਹੈ ਅਤੇ ਅਲਟੀਮੇਟਲੀ ਤਿਆਰੀ ਕਰਕੇ ਉਹ ਇੱਕ ਪੀ ਪੀ ਐੱਸ ਅਧਿਕਾਰੀ ਦੇ ਰੂਪ ਵਿਚ ਲੋਕਾਂ ਸਾਹਮਣੇ ਪੇਸ਼ ਹੁੰਦਾ ਹੈ